ਅੱਜ ਕੱਲ੍ਹ ਖੇਤੀਬਾੜੀ ਵਿੱਚ ਕਈ ਜਿਹੜੀ ਤਕਨੀਕੀ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹੈ ਜਿਵੇਂ ਕਿ ਪਹਿਲੇ ਜਿਹੜੀ ਬਿਜਾਈ ਹੁੰਦੀ ਸੀਗੀ ਉਹ ਹਲ ਨਾਲ ਹੁੰਦੀ ਸੀਗੀ ਜਿਹਦੀ ਜਗ੍ਹਾ ਅੱਜ ਕੀ ਆ ਟਰੈਕਟਰ ਨੇ ਲੈ ਲਈ ਆ ਅਤੇ ਵਢਾਈ ਅੱਗੇ ਵਢਾਈ ਨੂੰ ਬਹੁਤ ਟਾਇਮ ਲੱਗਦਾ ਹੁੰਦਾ ਸੀਗਾ ਹੱਥੀਂ ਵਢਾਈ ਹੁੰਦੀ ਸੀਗੀ ਕਿਸੇ ਵੀ ਕਣਕ ਦੀ ਲਗਾ ਲਉ ਹੈ ਨਾ ਜਾਂ ਝੋਨੇ ਦੀ ਅੱਜ ਕੱਲ੍ਹ ਕੀ ਹੈ ਜਿਹੜੀ ਕੰਬਾਇਨ ਹੈ ਉਹਨੇ ਉਹ ਜਿਹੜੀ ਉਹਦੀ ਜਗ੍ਹਾ ਹੈ ਲੈ ਲਈ ਆ ਅਤੇ ਕਈ ਅੱਜ ਕੱਲ੍ਹ ਦੇ ਜਿਹੜੀਆਂ ਖੇਤੀਬਾੜੀ 'ਚ ਤਕਨੀਕੀ ਤਬਦੀਲੀਆਂ ਆ ਰਹੀਆਂ ਹੈ ਇਹਨੇ ਸਾਡੀ ਜ਼ਿੰਦਗੀ ਆ ਕਾਫ਼ੀ ਸੁਖਾਲੀ ਵੀ ਬਣਾ ਦਿੱਤੀ ਆ